ਪੰਜਾਬੀ ਭਾਸ਼ਾ ਪੰਜਾਬੀਆਂ ਦੀ ਜਿਹੜੀ ਆ ਉਹ ਮਾਂ ਬੋਲੀ ਆ ਅਤੇ ਹਿੰਦੀ ਜਿਹੜੀ ਭਾਸ਼ਾ ਵਾ ਉਹ ਆਪਣੀ ਰਾਸ਼ਟਰੀ ਭਾਸ਼ਾ ਵਾ ਤੇ ਪੰਜਾਬੀ ਅਤੇ ਹਿੰਦੀ ਜਿਹੜੇ ਉਹ ਦੋਵੇਂ ਰਲਦੀਆਂ ਮਿਲਦੀਆਂ ਵਾ ਜਿਹੜੀ ਸਾਡੀ ਪੰਜਾਬੀ ਭਾਸ਼ਾ ਵਾ ਇਹਦੇ ਉਰਦੂ ਅਤੇ ਬੰਗਾਲੀ ਅਤੇ ਹਰਿਆਣਵੀ ਭਾਸ਼ਾ ਦੇ ਨਾਲ ਬਹੁਤ ਜ਼ਿਆਦਾ ਮਿਲਦੀ ਜੁਲਦੀ ਆ ਪਰ ਫਿਰ ਵੀ ਕੁਝ ਨਾ ਕੁਝ ਦੋਵਾਂ 'ਚ ਅੰਤਰ ਹੈਗਾ ਵਾ ਜਿਹੜੀ ਪੰਜਾਬੀ ਅਤੇ ਹਿੰਦੀ ਦੇ ਸ਼ਬਦ ਆ ਉਹ ਮਿਲਦੇ ਜੁਲਦੇ ਆ ਪਰ ਫਿਰ ਵੀ ਉਹਨਾਂ 'ਚ ਫਰਕ ਹੈਗਾ ਵਾ ਅਤੇ ਜਿਹੜਾ ਉਹ ਫਰਕ ਆ ਉਹ ਇਹਨਾਂ ਦੋਵਾਂ ਨੂੰ ਬਹੁਤ ਵੱਖਰਾ ਵੱਖਰਾ ਕਰ ਦਿੰਦਾ ਵਾ ਪੰ ਇਹ ਜਿਵੇਂ ਕਿ ਪੰਜਾਬ ਵਿੱਚ ਜ਼ਿਆਦਾਤਰ ਲੋਕ ਪੰਜਾਬੀ ਬੋਲਦੇ ਨੇ ਅਤੇ ਜਿਹੜੇ ਰਾਸ਼ਟਰੀ ਪੱਧਰ 'ਤੇ ਉਹ ਹਿੰਦੀ ਦੀ ਵਰਤੋਂ ਕਰਦੇ ਨੇ ਜ਼ਿਆਦਾ ਪਰ ਹੁਣ ਟਾਈਮ ਇਹੋ ਜਿਹਾ ਵਾ ਕਿ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਪੰਜਾਬੀ ਦੀ ਵੀ ਵਰਤੋਂ ਕਰਨ ਲੱਗ ਗਏ ਆ ਬਹੁਤ ਵੱਖਰੇ ਵੱਖਰੇ ਦੇਸ਼ਾਂ ਦੇ ਲੋਕ ਪੰਜਾਬੀ ਨੂੰ ਸਿੱਖ ਰਹੇ ਆ ਹਿੰਦੀ ਤਾਂ ਜਿਵੇਂ ਕਿ ਹਰ ਇੱਕ ਨੂੰ ਬੋਲਣੀ ਆਉਂਦੀ ਆ ਪਰ ਹੁਣ ਲੋਕ ਵੇਖ ਵੇਖ ਕੇ ਪੰਜਾਬੀ ਵੀ ਬੋਲਣੀ ਸਿੱਖ ਰਹੇ ਆ ਜਿਵੇਂ ਕੋਈ ਬਾਹਰਲੇ ਦੇਸ਼ਾਂ ਤੋਂ ਆਉਂਦਾ ਵਾ ਉਹਨੂੰ ਵੀ ਹਿੰਦੀ ਆਉਂਦੀ ਆ ਅਤੇ ਜਦੋਂ ਉਹ ਸਾਡੇ ਨਾਲ ਕੋਈ ਗੱਲਬਾਤ ਕਰਦੇ ਆ ਤਾਂ ਉਹ ਹਿੰਦੀ ਵਿੱਚ ਕਰ ਲੈਂਦੇ ਇਹਦੇ ਨਾਲ ਸਾਨੂੰ ਵੀ ਸੌਖਾ ਹੋ ਜਾਂਦਾ ਵਾ ਅਤੇ ਉਹਨਾਂ ਨੂੰ ਵੀ ਸੌਖਾ ਹੋ ਜਾਂਦਾ